ਮੈਂ ਐੱਮ ਆਈ ਟਵੈਲਵ ਦੀ ਬਹੁਤ ਐਡ ਦੇਖੀ ਬਹੁਤ ਐਡ ਆ ਰਹੀ ਸੀਗੀ ਇਹ ਫੋਨ ਬਹੁਤ ਵਧੀਆ ਵਾ ਮੈਂ ਜਦੋਂ ਮੈਂ ਇਹਦੇ ਰਿਵਿਊ ਚੈੱਕ ਕੀਤੇ ਸਭ ਕੁਛ ਬਹੁਤ ਵਧੀਆ ਦਿਖ ਰਿਹਾ ਸੀ ਫਿਫਟੀ ਐੱਮ ਮੈਗਾ ਪਿਕਸਲ ਕੈਮਰਾ ਵਾ ਕ੍ਰਿਸਟਲ ਗਲਾਸ ਡਿਜ਼ਾਇਨ ਆ ਕਲਰ ਵੀ ਬਹੁਤ ਸੋਹਣਾ ਸੀ ਮੈਂ ਬਹੁਤ ਰਿਵਿਊ ਚੈੱਕ ਕੀਤੇ ਪੂਰਾ ਇਹਦਾ ਡਾਟਾ ਚੈੱਕ ਕੀਤਾ ਬਹੁਤ ਵਧੀਆ ਲੱਗਾ ਮੈਨੂੰ ਸ ਸਕਰੀਨ ਇਹਦੀ ਬਹੁਤ ਲਾਰਜ ਸੀ ਫਿਰ ਮੈਂ ਇਸਨੂੰ ਜਦੋਂ ਖ਼ਰੀਦਿਆ ਜਦੋਂ ਮੈਂ ਇਹਨੂੰ ਘਰ ਆ ਕੇ ਓਪਨ ਕੀਤਾ ਅਤੇ ਮੈਨੂੰ ਉਸ ਤਰ੍ਹਾਂ ਦਾ ਕੁਛ ਵੀ ਨਹੀਂ ਮਿਲਿਆ ਗਨ ਗਲਾਸ ਜਿਸ ਤਰ੍ਹਾਂ ਦਾ ਮੈਨੂੰ ਗਾਰਡ ਕਿਹਾ ਸੀ ਉਹ ਉਹ ਕਲਰ ਹੀ ਨਹੀਂ ਮਿਲਿਆ ਗਲਾਸ ਕ੍ਰਿਸਟਲ ਗਲਾਸ ਵਾਲੀ ਕੋਈ ਉਹਦੇ 'ਚ ਗੱਲ ਨਹੀਂ ਸੀ ਕੈਮਰਾ ਵੀ ਮੈਨੂੰ ਉਹ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਫਿਫਟੀ ਉਸ ਤਰ੍ਹਾਂ ਉੰਨੀ ਕਲੈਰਟੀ ਨਹੀਂ ਮੈਨੂੰ ਦਿਖੀ ਉਹ ਤ ਵਧੀਆ ਨਹੀਂ ਲੱਗਾ ਮਤਲਬ ਉਹਦਾ ਕਿ ਫਾ ਫਾਈਵ ਜੀ ਕਰਕੇ ਨੈੱਟ ਵੀ ਉੰਨਾ ਫਾਸਟ ਨਹੀਂ ਚੱਲਦਾ ਮੈਨੂੰ ਜਰਾ ਪਸੰਦ ਨਹੀਂ ਆਇਆ ਕੋਈ ਉਹਦੇ 'ਚ ਜਿਸ ਤਰ੍ਹਾਂ ਉਹਨਾਂ ਦੱਸਿਆ ਸੀ ਕੈਮਰੇ ਦੀ ਕੁਆਲਿਟੀ ਹੋਏਗੀ ਇੰਝ ਵਧੀਆ ਲੱਗੇਗਾ ਕੈਮਰੇ ਦੀ ਕੁਆਲਿਟੀ ਵੀ ਮੈਨੂੰ ਵਧੀਆ ਨਹੀਂ ਲੱਗੀ ਸਟੋਰੇਜ ਦੀ ਵੀ ਮੈਨੂੰ ਸਟੋਰੇਜ ਦਾ ਵੀ ਜਿਸ ਤਰ੍ਹਾਂ ਉਹਨਾਂ ਨੇ ਫੰਕਸ਼ਨ ਦੱਸੇ ਸੀ ਉਸ ਤਰ੍ਹਾਂ ਦੇ ਫੰਕਸ਼ਨ ਨਹੀਂ ਮੈਨੂੰ ਚੰਗੇ ਲੱਗੇ ਕੁਆਲਿਟੀ ਬਿਲਕੁਲ ਨਹੀਂ ਇਹਦੀ ਮੈਨੂੰ ਵਧੀਆ ਲੱਗੀ ਮੇਰਾ ਐਕਸਪੀਰੀਅੰਸ ਇੰਨਾ ਵਧੀਆ ਨਹੀਂ ਰਿਹਾ ਇਸਦਾ ਬਹੁਤ ਸਾਰੇ ਰਿਵਿਊ ਚੈੱਕ ਕੀਤੇ ਸੀ ਜਦੋਂ ਮੈਂ ਬਹੁਤ ਹੀ ਵਧੀਆ ਲੱਗਣ ਦਿਆਂ ਸੀ ਇਹਦੇ ਨਾਲ ਓਫਰਜ਼ ਕਿਹਾ ਗਿਆ ਸੀ ਕਿ ਕਾਫ਼ੀ ਮੈਨੂੰ ਗਿਫਟ ਮਿਲਣਗੇ ਮੈਨੂੰ ਕੋਈ ਇਹਦੇ ਨਾਲ ਗਿਫਟ ਵੀ ਨਹੀਂ ਮਿਲਿਆ ਉਹ ਵੀ ਮੈਨੂੰ ਗਲਾਸ ਕੁਛ ਵੀ ਮਤਲਬ ਇਹਦੇ 'ਚ ਮੈਨੂੰ ਪਸੰਦ ਹੀ ਨਹੀਂ ਆਇਆ ਇਹਦਾ ਰਿਵਿਊ ਇਹ ਹੀ ਹੈ ਕਿ ਮੈਨੂੰ ਇਹ ਬਿਲਕੁਲ ਨੈਗਟਿਵ ਮੇਰਾ ਐਕਸਪੀਰੀਅੰਸ ਬਹੁਤ ਜ਼ਿਆਦਾ ਨੈਗਟਿਵ ਰਿਹਾ ਇਸ ਤੋਂ